ਵੈਸੇ ਤਾਂ ਸਾਡੇ ਬਹੁਤ ਸਾਰੇ ਲੇਖਕ ਨੇ ਅਤੇ ਕਵੀ ਨੇ ਅਤੇ ਮੇਰਾ ਜੋ ਮਨਪਸੰਦ ਲੇਖਕ ਹੈ ਉਹ ਹੈ ਸ਼ਿਵ ਕੁਮਾਰ ਬਟਾਲਵੀ ਉਹ ਬਹੁਤ ਹੀ ਮਸ਼ਹੂਰ ਲੇਖਕ ਨੇ ਅਤੇ ਕਵਿਤਾਵਾਂ ਵੀ ਉਹਨਾਂ ਦੀਆਂ ਬਹੁਤ ਹੀ ਵਧੀਆ ਸੁਣਨ ਵਾਲੀਆਂ ਹੁੰਦੀਆਂ ਨੇ ਕੋਈ ਜਿਹੜੇ ਮਰਜ਼ੀ ਹਾਲਾਤਾਂ ਵਿੱਚ ਹੋਵੇ ਕੋਈ ਦੁੱਖ 'ਚੋਂ ਗੁਜ਼ਰ ਰਿਹਾ ਕੋਈ ਸੁੱਖ 'ਚੋਂ ਗੁਜ਼ਰ ਰਿਹਾ ਉਸ ਵੇਲੇ ਦੀਆਂ ਹਰ ਇੱਕ ਤਰ੍ਹਾਂ ਦੀਆਂ ਉਹਨਾਂ ਕੋਲ ਸ਼ੇਅਰ ਨੇ ਕਵਿਤਾਵਾਂ ਨੇ ਬਹੁਤ ਹੀ ਕੁਛ ਆ ਉਹਨਾਂ ਦੇ ਕਾਫ਼ੀ ਸਾਰੇ ਗੀਤ ਵੀ ਨੇ ਜੋ ਕਿ ਬਹੁਤ ਮਸ਼ਹੂਰ ਨੇ ਜੋ ਪੰਜਾਬੀ ਸਿੰਗਰ ਉਹਨਾਂ ਦੇ ਲਿਖੇ ਹੋਏ ਬੋਲਦੇ ਨੇ ਮੇਰੇ ਉਹ ਬਹੁਤ ਮਨਪਸੰਦ ਨੇ ਅਤੇ ਸਾਡੇ ਬਟਾਲੇ ਸ਼ਹਿਰ 'ਚ ਹੀ ਰਹਿੰਦੇ ਸੀ ਧੰਨਵਾਦ